ਹਾਂਜੀ ਹਾਂਜੀ ਸਰ ਬੋਲੋ ਜੀ ਹਾਂਜੀ ਹਾਂਜੀ ਸਰ ਬੋਲੋ ਸਤਿ ਸ਼੍ਰੀ ਅਕਾਲ ਹਾਂਜੀ ਲ ਦੇਖੋ ਆਪਣੇ ਮਤਲਬ ਪੰਜਾਬ 'ਚ ਹੈਡ ਆਫਿਸ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਜਲੰਧਰ ਅਤੇ ਫਿਰੋਜ਼ਪੁਰ ਇੱਥੇ ਮਤਲਬ ਆਪਣੇ ਪਾਸਪੋਰਟ ਅਪਲਾਈ ਹੁੰਦੇ ਨੇ ਅਤੇ ਤੁਹਾਨੂੰ ਮਤਲਬ ਜੇ ਜ਼ਿਆਦਾ ਵੈਸੇ ਤਾਂ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ ਮਹੀਨੇ ਕੁ ਦੇ ਵਿੱਚ ਹੀ ਪਾਸਪੋਰਟ ਆ ਜਾਂਦਾ ਹੁੰਦਾ ਡੇਟ ਮਿਲ ਜਾਂਦੀ ਆ

ਅਤੇ ਸਰ ਜੇ ਐਮਰਜੈਂਸੀ ਆ ਤਾਂ ਇਹ ਨਾ ਤਤਕਲਾਂ ਤਤਕਾਲੀਨ 'ਚ ਮਤਲਬ ਆਪਾਂ ਅਪਲਾਈ ਕਰ ਸਕਦੇ ਹਾਂ ਤੁਸੀਂ ਉਹਦੇ ਵਿੱਚ ਸਰ ਇਹ ਹੁੰਦਾ ਵੀ ਉਹਦੀ ਫੀਸ ਆ ਉਹ ਥੋੜ੍ਹੀ ਜਿਹੀ ਜ਼ਿਆਦਾ ਹੁੰਦੀ ਆ ਹਾਂਜੀ ਸਰ ਇਹ ਇੰਝ ਨਹੀਂ ਹੁੰਦਾ ਗਾ ਅਸੀਂ ਨਾ ਮਤਲਬ ਕੋਈ ਗੱਲ ਨਹੀਂ ਜੇ ਤੁਹਾਨੂੰ ਐਮਰਜੈਂਸੀ ਆ ਵੀ ਤੁਸੀਂ ਥੋੜ੍ਹਾ ਜਿਹਾ ਜਲਦੀ ਡੇਟ ਲੈਣਾ ਚਾਹੁੰਦੇ ਹੋ ਪਾਸਪੋਰਟ ਦੀ ਅਸੀਂ ਚੈੱਕ ਕਰਾਂਗੇ ਵੀ ਜਿੱਥੇ ਵੀ ਸਲੋਟ ਫਰੀ ਹੋਇਆ ਜਿਹੜੀ ਡੇਟ ਦਾ ਵੀ ਤਾਂ ਫਿਰ ਅਸੀਂ ਤੁਹਾਨੂੰ ਮਤਲਬ ਕਾਲ ਕਰਕੇ ਦੱਸ ਦਾਂਗੇ ਵੀ ਤੁਸੀਂ ਕਿੱਥੇ ਜਾਓ ਵੈਸੇ ਤੁਹਾਨੂੰ ਨਜ਼ਦੀਕ ਫਿਰੋਜ਼ਪੁਰ ਪਵੇਗਾ ਅਤੇ ਫਿਰੋਜ਼ਪੁਰ ਉਹ ਅਸੀਂ ਮਤਲਬ ਸੁਬਹ ਚੈੱਕ ਕਰਾਂਗੇ ਸਰ ਨੌ ਵਜੇ ਹਾਂਜੀ ਚੈੱਕ ਕਰਕੇ ਅਤੇ ਉਹਦੇ ਵਿੱਚ ਜਦੋਂ ਵੀ ਮਤਲਬ ਸਲੋਟ ਫਰੀ ਹੋਇਆ ਜਿਹੜੀ ਡੇਟ ਦਾ ਤਾਂ ਉਹ ਭੇਜ ਦਾਂ ਸਲੈਕਟ ਕਰਕੇ ਅਤੇ ਤੁਹਾਨੂੰ ਇਨਫੋਰਮੇਸ਼ਨ ਦੇ ਦਾਂਗੇ ਅਤੇ ਤੁਸੀਂ ਫਿਰੋਜ਼ਪੁਰ ਹੀ ਤੁਹਾਨੂੰ ਨੇੜੇ ਪਊਗਾ ਉੱਥੇ ਹੀ ਵਿਜਿਟ ਕਰ ਲਿਓ ਹਾਂਜੀ ਉਹ ਵੀ ਬਹੁਤ ਵਧੀਆ ਉਹਨਾਂ ਦੀ ਸਰਵਿਸ ਆ ਬਹੁਤ ਵਧੀਆ ਗੱਲ ਕਰਦੇ ਨੇ ਕਸਟਮਰ ਨੂੰ ਵਧੀਆ ਡੀਲ ਕਰਦੇ ਨੇ ਅਤੇ ਨਾਲ ਤੁਹਾਡਾ ਮਤਲਬ ਟਾਈਮ ਬਚੇਗਾ ਹਾਂਜੀ ਅਤੇ ਇਹਦੀ ਬਸ ਫੀਸ ਦਾ ਹੈ ਸਰ ਵੀ ਥੋੜ੍ਹਾ ਜਿਹਾ ਫੀਸ ਜ਼ਿਆਦਾ ਵੈਸੇ ਤਾਂ ਚਲੋ ਤੁਹਾਨੂੰ ਐਮਰਜੈਂਸੀ ਆ ਤਾਂ ਕਰਕੇ ਪਹਿਲਾਂ ਬੁੱਕ ਕਰਵਾ ਕੇ ਦੇ ਦਿੰਦੇ ਹਾਂ ਹਾਂਜੀ ਅਤੇ ਕੋਈ ਗੱਲ ਨਹੀਂ ਤੁਸੀਂ ਆਪਣੇ ਹਾਂਜੀ ਜੋ ਵੀ ਡਾਕੂਮੈਂਟ ਆ ਅਤੇ ਆਪਦਾ ਮਤਲਬ ਬਰਥ ਸਰਟੀਫਿਕੇਟ ਆਧਾਰ ਕਾਰਡ ਪੈਨ ਕਾਰਡ ਅਤੇ ਇਹ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ ਹਾਂਜੀ ਅਤੇ ਤੁਸੀਂ ਇਹ ਪਹਿਲੀ ਵਾਰ ਅਪਲਾਈ ਕਰ ਰਹੇ ਹੋ ਜੀ ਠੀਕ ਹੈ ਵੀ ਪਹਿਲਾਂ ਨਹੀਂ ਤੁਸੀਂ ਹੁਣ ਟਰਾਈ ਕੀਤਾ ਸੀਗਾ ਵੀ ਐਮਰਜੈਂਸੀ 'ਚ ਤੁਹਾਨੂੰ ਕੋਈ ਡੇਟ ਨਹੀਂ ਮਿਲੀ ਹੈ ਨਾ ਹੁੰ ਹੁੰ ਹੁੰ ਕੋਈ ਗੱਲ ਨਹੀਂ ਸਰ ਅਸੀਂ ਮਤਲਬ ਇਹ ਚੈੱਕ ਕਰਕੇ ਵੀ ਇਸ ਮਹੀਨੇ ਦੇ ਵਿੱਚ ਕਿਹੜੀ ਡੇਟ ਫ੍ਰੀ ਆ ਪਾਸਪੋਰਟ ਅਪਲਾਈ ਕਰਨ ਦੀ ਉਹ ਤੁਹਾਨੂੰ ਚੈੱਕ ਕਰਕੇ ਅਸੀਂ ਅਤੇ ਤੁਹਾਨੂੰ ਮੈਸੇਜ ਲਾ ਦਾਂਗੇ ਹਾਂਜੀ ਅਤੇ ਤੁਸੀਂ ਵਿਜਿਟ ਕਰ ਲਿਓ ਕੋਈ ਗੱਲ ਨਹੀਂ ਪਾਸਪੋਰਟ ਤੁਹਾਡਾ ਬਣ ਜੇਗਾ ਹਾਂਜੀ ਹਾਂਜੀ ਉਹ ਤੁਹਾਨੂੰ ਮੈਸੇਜ ਲਾ ਦਾਂਗੇ ਜੀ ਅਸੀਂ ਠੀਕ ਹੈ ਓਕੇ